ਗੀਤ ਭਾਵਨਾ ਅਤੇ ਸੋਚ ਨੂੰ ਪ੍ਰਗਟ ਕਰਦਾ ਹੈ ਗੀਤਾ ਵਿੱਚ ਸਕੂਨਦਾਰੀ ਅਤੇ ਭਾਵਨਾਤਮਕ ਤੌਰ ਤੇ ਪੇਸ਼ਗਾਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਅੱਜ ਕੱਲ ਦੇ ਗੀਤਾਂ ਦੀ ਚੋਣ ਕਰਨਾ ਜਿਆਦਾ ਕਠਿਨ ਹੈ ਹਾਲਾਂਕਿ ਫਿਰ ਵੀ ਅਸੀਂ ਚੋਣ ਕਰ ਸਕਦੇ ਹਾਂ ਗੀਤ ਵਿੱਚ ਸਭ ਤੋਂ ਪਹਿਲਾਂ ਇੱਕ ਮਾਜੂਸੀ ਰੋਮੈਟਿਕ ਸੋਂਗ ਅਤੇ ਜਾ ਫਇਰ ਉਹਨਾਂ ਦੀ ਭਾਵਨਾ ਨੂੰ ਬਾਖੂਬੀ ਪੇਸ਼ ਕਰ ਕੀਤਾ ਜਾ ਸਕਦੀ ਹੈ ਅਤੇ ਉਹਨਾਂ ਦੀ ਅਸੀਂ ਚੋਣ ਕਰ ਸਕਦੇ ਹਾਂ ਗੀਤ ਵਿੱਚ ਸਭ ਤੋਂ ਪਹਿਲਾਂ ਜਿਆਦਾ ਲਿਖਤ ਦੀ ਹੀ ਲਿਖਤ ਦੀ ਹੀ ਪੇਸ਼ਕਾਰੀ ਹੋਣੀ ਚਾਹੀਦੀ ਹੈ ਅਤੇ ਕਿਵੇਂ ਉਸਦੀ ਕੰਪੋਜੀਸ਼ਨ ਵਿੱਚ ਕਿਵੇਂ ਉਸ ਨੂੰ ਪਰੋਇਆ ਜਾ ਸਕਦਾ ਹੈ ਉਸ ਸਮੇਂ ਗੀਤ ਦੀ ਚੋਣ ਕਰ ਸਕਦੇ ਹਾਂ ਜਿਹੜੇ ਕਿ ਰਿਕਾਰਡ ਸੌਂਗ ਸਕੂਨਦਾਰੀ ਹੋਣੀ ਚਾਹੀਦੇ ਹਨ ਜਿਆਦਾ ਭੜਕੀਲੇ ਸੌਂਗ ਨਹੀਂ ਹੋਣੇ ਚਾਹੀਦੇ ਭੜਕਾਊ ਸੌਂਗ ਭੜਕਾਊ ਸੋਂਗ ਸਰੋਤਿਆਂ ਨੂੰ ਸਰੋਤਿਆਂ ਨੂੰ ਪਸੰਦ ਤਾਂ ਆਉਂਦੇ ਹਨ ਪਰ ਜਿਆਦਾ ਸਾਨੂੰ ਸਕੂਨਦਾਰੀ ਗਾਇਕੀ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਮੇਰੀ ਮੰਨਣਾ ਹੈ ਕਿ ਗੀਤ ਇੱਕ ਸਕੂਨਦਾਰ ਹੋਣਾ ਚਾਹੀਦਾ ਹੈ ਜਿਸ ਨੂੰ ਸੁਣ ਕੇ ਸਕੂਨਦਾਰੀ ਦਾ ਮਹਿਸੂਸ ਹੋਣਾ ਚਾਹੀਦਾ ਹੈ ਭਾਵਨਾਤਮਕ ਤੌਰ ਤੇ ਸੈਡ ਸੌਂਗ ਜਾਂ ਰੋਮੈਂਟਿਕ ਸੌਂਗ ਅਜਿਹੇ ਹੋਣੇ ਚਾਹੀਦੇ ਹਨ ਜੋ ਕਿ ਸਾਡੇ ਸੱਭਿਆਚਾਰ ਨਾਲ ਜੁੜੇ ਹੋਣੇ ਚਾਹੀਦੇ ਹਨ ਸੱਭਿਆਚਾਰ ਵਾਲੇ ਗੀਤ ਸਾਨੂੰ ਜਿਆਦਾ ਪਸੰਦ ਆਉਣੇ ਚਾਹੀਦੇ ਹਨ ਜਾਨੀ ਕਿ ਸੌਂਗ ਵਿੱਚ ਜਿਆਦਾ ਭੜਕੀਲੇ ਸੋ ਭੜਕੀਲ ਭੜਕੀਲਾਪਣ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਸਕੂਨਦਾਰੀ ਗਾਇਕੀ ਵੱਲ ਅਤੇ ਗੀਤ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਗੀਤਾਂ ਦੀ ਲਿਖਤ ਨੂੰ ਹੀ ਅਤੇ ਉਹਨਾਂ ਦੇ ਕੰਪੋਜੀਸ਼ਨ ਨੂੰ ਬਿਆਨ ਕਰਨ ਲਈ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਸਾਨੂੰ ਸਕੂਨਦਾਰੀ ਗੀਤ ਹੀ ਰਿਕਾਰਡ ਕਰਨੇ ਚਾਹੀਦੇ ਹਨ ਮੇਰਾ ਮੰਨਣਾ ਹੈ ਕਿ ਗੀਤ ਇੱਕ ਸਕੂਨਦਾਰ ਹੋਣੇ ਹੀ ਚਾਹੀਦੇ ਹਨ